ਜਦੋਂ ਅਸੀਂ ਆਪਣੇ ਪੰਜਾਬ ਤੋਂ ਬਾਹਰ ਕਿਤੇ ਜਾਂਦੇ ਹਾਂ ਤਾਂ ਸਾਨੂੰ ਉੱਥੇ ਥੋੜ੍ਹਾ ਇਹਨਾਂ ਚੀਜ਼ਾਂ ਦਾ ਪੱਖ ਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਉਹ ਸਾਡੀ ਬੋਲੀ ਨੂੰ ਲੈ ਕੇ ਜਾਂ ਹਿਮਾਚਲ ਵਾਲੇ ਜਾਂ ਕੁਛ ਵੀ ਆਪਣੇ ਪੰਜਾਬ ਤੋਂ ਬਾਹਰ ਅਸੀਂ ਜਾਂਦੇ ਹਾਂ ਸਾਡਾ ਪੱਖ ਪਾਤ ਹੁੰਦਾ ਆ ਠੀਕ ਆ ਉਹ ਸਾਡਾ ਸਹੀ ਤਰ੍ਹਾਂ ਬਿਹੇਵ ਨਹੀਂ ਕਰਦੇ ਕੁਛ ਐਸ ਤਰ੍ਹਾਂ ਦਾ ਹੈਗਾ ਜਿੱਦਾਂ ਕਿ ਉਹ ਬੱਸਾਂ ਵਿੱਚ ਵੀ ਸਾਨੂੰ ਬਹੁਤ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਉੱਥੇ ਸ਼ੋਪਿੰਗ ਨੂੰ ਲੈ ਕੇ ਹੋ ਜਾਂਦਾ ਆ ਜਾਂ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬਾਹਰੋਂ ਆਏ ਆ ਇਹਨਾਂ ਨੂੰ ਰੇਟ ਜ਼ਿਆਦਾ ਲਾਈਏ ਇਹਨਾਂ ਚੀਜਾਂ ਨੂੰ ਲੈ ਕੇ ਪੱਖਪਾਤ ਦਾ ਸਾਹਮਣਾ ਹੁੰਦਾ ਆ ਬਾਹਰ ਅਸੀਂ ਕਦੇ ਵੀ ਕਿਸੇ ਜਗ੍ਹਾ ਘੁੰਮਣ ਜਾਣੇ ਆ ਪੰਜਾਬ ਤੋਂ ਕਿਤੇ ਵੀ ਦੂਰ ਚਲੇ ਜਾਈਏ ਫਿਰ ਉਹਨਾਂ ਨੂੰ ਪਤਾ ਹੁੰਦਾ ਕੀ ਇਹ ਪੰਜਾਬ ਤੋਂ ਦੂਰ ਆਏ ਆ ਇਸ ਕਰਕੇ ਉਹ ਪੱਖਪਾਤ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੀ ਆ ਹਰ ਵਾਰ